ਵਿਗਿਆਨ ਤੇ ਟੈਕਨੋਲੋਜੀ ਹੈ ਜਿਹੜੀ ਉਹ ਅੱਜ ਦੇ ਸਮੇਂ 'ਚ ਹਰ ਇੱਕ ਮਨੁੱਖ ਨੂੰ ਆਪਣੇ ਵੱਲ ਖਿੱਚਦੀ ਹੈ ਕਿਉਂਕਿ ਵਿਗਿਆਨ ਸਾਨੂੰ ਜਿਹੜੇ ਫਾਲਤੂ ਦੇ ਪਖੰਡ ਅਤੇ ਪ੍ਰਪੰਚ ਨੇ ਉਹਨਾਂ ਤੋਂ ਦੂਰ ਕਰਦੀ ਹੈ ਇਹ ਸਾਨੂੰ ਸੋਚਣਾ ਸਿਖਾਉਂਦੀ ਹੈ ਅਸੀਂ ਕਿਸੇ ਵੀ ਵਰਤਾਰੇ ਨੂੰ ਜੋ ਸਾਡੇ ਕੁਦਰਤ 'ਚ ਵਰਤ ਰਿਹਾ ਬਸ਼ੱਕ ਉਹ ਸਾਡੇ ਆਲੇ ਦੁਆਲੇ 'ਚ ਵਰਤ ਰਿਹਾ ਉਹਨੂੰ ਅਸੀਂ ਅੱਖਾਂ ਮੀਟ ਕੇ ਐਵੇਂ ਹੀ ਕਿਸੇ ਵੀ ਗੱਲ ਨੂੰ ਐਕਸੈਪਟ ਨਹੀਂ ਕਰਦੇ ਬਲਕਿ ਉਹਦੇ ਪਿੱਛੇ ਕਾਰਨ ਜਿਹੜੇ ਕਾਰਨ ਹੈਗੇ ਉਹਨਾਂ ਨੂੰ ਲੱਭਦੇ ਆਂ ਅਸੀਂ ਦੇਖਦੇ ਆਂ ਵੀ ਜੇਕਰ ਕੋਈ ਵਰਤਾਰਾ ਵਰਤ ਰਿਹਾ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਕਿਹੜੇ ਤੱਥ ਨੇ ਜਾਂ ਕਿਹੜੇ ਤੱਤ ਹੈਗੇ ਜਿਹੜੇ ਉਸ ਕਾਰਜ ਹੋਣ ਦੇ ਪਿੱਛੇ ਹੈਗੇ ਇਹੀ ਕਾਰਨ ਹੈ ਕਿ ਵਿਗਿਆਨ ਸਭ ਤੋਂ ਜਿਆਦਾ ਜਿਹੜਾ ਅੱਜ ਦੇ ਸਮੇਂ ਮਨੁੱਖ ਨੂੰ ਖਿੱਚ ਰਿਹਾ ਕਿਉਂਕਿ ਇਹਦੇ ਨਾਲ ਜਿੱਥੇ ਬਹੁਤ ਸਾਰੀਆਂ ਖੋਜਾਂ ਹੋਈਆਂ ਜਿਸ ਨਾਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਹ ਬਹੁਤ ਜਿਆਦਾ ਸੁਖਾਲੀ ਹੋਈ ਜੇਕਰ ਅਸੀਂ ਸਾਡੀ ਰਸੋਈ ਦੀ ਉਦਾਹਰਨ ਲਈਏ ਤਾਂ ਘੰਟਿਆਂ ਵਿੱਚ ਹੋਣ ਆਲੇ ਕੰਮ ਮਿੰਟਾਂ ਵਿੱਚ ਹੋਣ ਲੱਗ ਗਏ ਜਿਹਦੇ ਨਾਲ ਸਾਡੀ ਜ਼ਿੰਦਗੀ ਸੁਖਾਲੀ ਹੋਈ ਤੇ ਵਿਗਿਆਨ ਸਾਨੂੰ ਆਪਣੇ ਵੱਲ ਖਿੱਚਣ ਲੱਗਿਆ